ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਠੀਕ ਹੈ ਜੀ ਪੰਜਾਬ ਵਿੱਚ ਬਹੁਤ ਸਾਰੀਆਂ ਪਲੇਸਿਸ ਹੈ ਜਿੱਥੇ ਤੁਸੀਂ ਘੁੰਮ ਸਕਦੇ ਹੋ ਜਿਵੇਂ ਕਿ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੈ ਇਤਿਹਾਸਿਕ ਸਥਾਨ ਹੈ ਗੋਲਡਨ ਟੈਂਪਲ ਤੁਸੀਂ ਉੱਥੇ ਵੀ ਘੁੰਮ ਸਕਦੇ ਹੋ ਅੰਮ੍ਰਿਤਸਰ ਦੇ ਵਿੱਚ ਇੱਕ ਬਾਘਾ ਬੋਡਰ ਹੈ ਉੱਥੇ ਵੀ ਜਾ ਸਕਦੇ ਹੋ ਹੋਰ ਜਿਸ ਤਰ੍ਹਾਂ ਫਤਿਹਗੜ੍ਹ ਸਾਹਿਬ ਹੈ ਉੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀਗੀ ਤੁਸੀਂ ਉੱਥੇ ਵੀ ਘੁੰਮ ਸਕਦੇ ਹੋ ਹੋਰ ਵੀ ਬਹੁਤ ਸਾਰੀਆਂ ਜਗ੍ਹਾਵਾਂ ਹੈ ਜਿਸ ਤਰ੍ਹਾਂ ਲੁਧਿਆਣਾ ਦੇ ਵਿੱਚ ਆਪਣੇ ਕੋਲ ਪਾਰਕ ਪਲਾਜ਼ਾ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਹੋਰ ਵੀ ਬਹੁਤ ਸਾਰੇ ਜਿਸ ਤਰ੍ਹਾਂ ਕਿ ਮੋਰਿੰਡੇ ਦੇ ਵਿੱਚ ਵੀ ਗੰਗੂ ਦਾ ਘਰ ਹੈ ਤੁਸੀਂ ਉਹ ਦੇਖ ਸਕਦੇ ਹੋ ਆਨੰਦਪੁਰ ਸਾਹਿਬ ਦੇ ਵਿੱਚ ਅਜੂਬਾ ਬਣਿਆ ਹੋਇਆ ਉਹ ਵੀ ਬਹੁਤ ਇਤਿਹਾਸਿਕ ਹੈ ਉੱਥੇ ਵੀ ਬਹੁਤ ਸਾਰੇ ਇਤਿਹਾਸਿਕ ਘਟਨਾ ਰਚਿਤ ਕੀਤੀਆਂ ਗਈਆਂ ਹਨ ਉੱਥੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਮਤਲਬ ਹੈਲੋ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਤੁਸੀਂ ਚਮਕੌਰ ਸਾਹਿਬ ਜਾ ਸਕਦੇ ਹੋ ਉੱਥੇ ਵੀ ਗੁਰਦੁਆਰਾ ਹੈ ਜਿੱਥੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀਗੀ ਉੱਥੇ ਵੀ ਅਜੂਬਾ ਬਣਿਆ ਹੋਇਆ ਹੈ ਇਹਨਾਂ ਦੀ ਘਟਨਾਵਾਂ ਨੂੰ ਰਚਿਤ ਕੀਤਾ ਹੋਇਆ ਜਿਹਦੇ ਵਿੱਚ ਉੱਥੇ ਵੀ ਤੁਹਾਨੂੰ ਬਹੁਤ ਸਾਰੇ ਬ ਵੱਡੇ ਸਾਹਿਬਜ਼ਾਦਿਆਂ ਦੇ ਇਤਿਹਾਸ ਦਾ ਪਤਾ ਲੱਗਦਾ ਹੈ ਹੋਰ ਵੀ ਪੰਜਾਬ ਵਿੱਚ ਬਹੁਤ ਸਾਰੀਆਂ ਪਲੇਸਿਸ ਹੈ ਜਿਸ ਤਰ੍ਹਾਂ ਹੈਲੋ ਪਟਿਆਲਾ ਦੇ ਵਿੱਚ ਵੀ ਗੁਰਦੁਆਰਾ ਹੈ ਇੱਕ ਦੁੱਖ ਨਿਵਾਰਨ ਸਾਹਿਬ ਤੁਸੀਂ ਉਹ ਦੇਖ ਸਕਦੇ ਹੋ ਕਪੂਰਥਲੇ ਦੇ ਵਿੱਚ ਇੱਕ ਫਨਸਿਟੀ ਕਪੂਰਥਲੇ ਦੇ ਵਿੱਚ ਸਾਇੰਸ ਸਿਟੀ ਬਣੀ ਹੋਈ ਹੈ ਤੁਸੀਂ ਉਹ ਵੀ ਦੇਖ ਸਕਦੇ ਹੋ ਹਾਂਜੀ ਹੋਰ ਮੈਮ ਇਹ ਪਲੇਸਿਸ ਹੈ ਜੀ ਜਿੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਜੀ